ਮੇਰੀ ਕਲਾਸ ਗਿਆਰ੍ਹਵੀਂ ਦੇ ਵਿੱਚ ਮੇਰੀ ਪੂਰੀ ਕਲਾਸ ਨੂੰ ਸਾਇੰਸ ਦੇ ਰਿਲੇਟਿਡ ਇੱਕ ਪ੍ਰੋਜੈਕਟ ਮਿਲਿਆ ਸੀ ਜਿਹਦੇ ਵਿੱਚ ਸਾਰੀ ਕਲਾਸ ਨੂੰ ਗਰੁੱਪਸ ਦੇ ਵਿੱਚ ਵੰਡਿਆ ਗਿਆ ਸੀ ਅਤੇ ਹਰ ਇੱਕ ਗਰੁੱਪ ਦੇ ਵਿੱਚੋਂ ਦੋ ਜਾਣੇ ਹੈਗੇ ਸੀ ਅਤੇ ਮੇਰੀ ਜਿਹੜੀ ਗਰੁੱਪ ਦੇ ਵਿੱਚ ਜਿਹੜੀ ਮੇਰੀ ਪਾਰਟਨਰ ਸੀ ਪ੍ਰੋਜੈਕਟ ਨੂੰ ਲੈ ਕੇ ਉਹ ਜਿਹੜੀ ਹੈਗੀ ਸੀ ਇੱਕ ਕੁੜੀ ਜਿਹਦੇ ਨਾਲ਼ ਮੇਰੀ ਪਹਿਲਾਂ ਦੋਸਤੀ ਹੈਗੀ ਸੀ ਪਰ ਕਿਸੇ ਕਾਰਨਾਂ ਕਰਕੇ ਸਾਡੀ ਜਿਹੜੀ ਦੋਸਤੀ ਆ ਉਹ ਟੁੱਟ ਗਈ ਸੀ ਅਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੀ ਪਾਰਟਨਰ ਆ ਉਹ ਅਤੇ ਉਹਨੂੰ ਵੀ ਪਤਾ ਲੱਗਿਆ ਤਾਂ ਅਸੀਂ ਦੋਵਾਂ ਨੇ ਕੋਸ਼ਿਸ਼ ਕੀਤੀ ਕਿ ਟ੍ਰਾਈ ਕਰਦੇ ਹਾਂ ਕਿ ਅਗਰ ਬਦਲ ਜੇ ਪਾਰਟਨਰ ਕਿਉਂਕਿ ਸਾਨੂੰ ਲੱਗਦਾ ਸੀ ਕਿ ਅਸੀਂ ਇੱਕ ਦੂਜੇ ਨਾਲ਼ ਕੋਪਰੇਟ ਨਹੀਂ ਕਰ ਪਾਵਾਂਗੇ ਅਤੇ ਅਸੀਂ ਟ੍ਰਾਈ ਕੀਤਾ ਮੈਮ ਨੂੰ ਦੱਸਿਆ ਬਟ ਕੋਈ ਵੀ ਜਿਹੜਾ ਹੈਗਾ ਆਪਣਾ ਪਾਰਟਨਰ ਬਦਲਣ ਲਈ ਰੈਡੀ ਨਹੀਂ ਸੀ ਅਤੇ ਇਸੇ ਕਰਕੇ ਅਸੀਂ ਸੋਚਿਆ ਕਿ ਚਲੋ ਕੋਈ ਨਾ ਆਪਾਂ ਦੋਵੇਂ ਹੀ ਮਿਲ ਕੇ ਜਿਹੜੇ ਹੈਗੇ ਆ ਉਸ ਪ੍ਰੋਜੈਕਟ ਨੂੰ ਪੂਰਾ ਕਰਾਂਗੇ ਅਤੇ ਜਦੋਂ ਵੀ ਮੈਨੂੰ ਬੜਾ ਸ਼ੁਰੂ 'ਚ ਔਖਾ ਲੱਗਦਾ ਸੀ ਕਿਉਂਕਿ ਮੇਰੀ ਜਿਹੜੀ ਦੋਸਤੀ ਆ ਬੜੀ ਬੁਰੇ ਤਰੀਕੇ ਨਾਲ਼ ਟੁੱਟੀ ਸੀ ਕੋਈ ਅਣਬਣ ਸਾਡੇ ਵਿੱਚ ਹੋ ਗਈ ਸੀ ਅਤੇ ਮੈਂ ਉਹਦੇ ਨਾਲ਼ ਗੱਲਬਾਤ ਕਰਦੀ ਵੀ ਨਹੀਂ ਸੀ ਨਾ ਹੀ ਉਹ ਮੇਰੇ ਨਾਲ਼ ਗੱਲਬਾਤ ਕਰਦੀ ਸੀ ਅਤੇ ਸ਼ੁਰੂ ਦੇ ਵਿੱਚ ਅਸੀਂ ਟ੍ਰਾਈ ਕੀਤਾ ਕਿ ਉਹ ਜਿਹੜੀ ਗਿਲੇ ਸ਼ਿਕਵੇ ਨੇ ਭੁੱਲ ਜੀਏ ਅਤੇ ਅਸੀਂ ਹੌਲੀ ਹੌਲੀ ਜਿਹੜੇ ਹੈਗੇ ਆ ਉਹਨਾਂ ਗਿਲੇ ਸ਼ਿਕਵਿਆਂ ਨੂੰ ਭੁੱਲ ਕੇ ਆਪਣਾ ਜਿਹੜਾ ਕੰਮ ਹੈ ਉਹਨੂੰ ਸ਼ੁਰੂ ਕੀਤਾ ਅਤੇ ਇੱਕ ਦੂਜੇ ਨਾਲ਼ ਉਵੇਂ ਹੀ ਗੱਲਬਾਤ ਕਰਨ ਲੱਗੇ ਜਿਵੇਂ ਇੱਕ ਸਾਨੂੰ ਦੋਸਤਾਂ ਵਾਂਗੂੰ ਕਰਨੀ ਚਾਹੀਦੀ ਹੈ ਹਾਲਾਂਕਿ ਅਸੀਂ ਇੱਕ ਦੂਜੇ ਨਾਲ਼ ਇੰਨੇ ਖੁੱਲ੍ਹੇ ਨਹੀਂ ਸੀ ਲੇਕਿਨ ਅਸੀਂ ਕੰਮ ਦੇ ਰਾਹੀਂ ਜਾਂ ਫਿਰ ਇੱਕ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਲਈ ਇੱਕ ਦੂਜੇ ਨਾਲ਼ ਗੱਲਬਾਤ ਵੀ ਕੀਤੀ ਅਤੇ ਇੱਕ ਦੂਜੇ ਨਾਲ਼ ਬੈਠੇ ਉੱਠੇ ਵੀ ਅਤੇ ਕਈ ਦਿਨ ਤੱਕ ਅਸੀਂ ਜਿਹੜਾ ਹੈ ਇੱਕ ਦੂਜੇ ਨਾਲ਼ ਰਹੇ ਇੱਕ ਦੂਜੇ ਨਾਲ਼ ਗੱਲਬਾਤ ਕੀਤੀ ਅਤੇ ਪ੍ਰੋਜੈਕਟ ਨੂੰ ਪੂਰਾ ਕੀਤਾ ਅਤੇ ਪ੍ਰੋਜੈਕਟ ਨੂੰ ਪੂਰਾ ਕਰਨ ਤੋਂ ਬਾਅਦ ਅਤੇ ਅਸੀਂ ਜਿਹੜਾ ਹੈਗਾ ਇੱਕ ਦੂਜੇ ਤੋਂ ਅਲੱਗ ਹੋ ਗਏ ਦੁਬਾਰਾ ਅਸੀਂ ਨਹੀਂ ਮਿਲੇ ਬਟ ਲੇਕਿਨ ਉਸ ਪ੍ਰੋਜੈਕਟ ਦੇ ਦੌਰਾਨ ਅਸੀਂ ਇਹ ਕੋਸ਼ਿਸ਼ ਕੀਤੀ ਸੀ ਕਿ ਕਿ ਅਸੀਂ ਇੱਕ ਦੂਜੇ ਨਾਲ਼ ਗੱਲਬਾਤ ਚੰਗੀ ਤਰ੍ਹਾਂ ਕਰੀਏ ਅਤੇ ਓਨੈਸਟੀ ਨਾਲ਼ ਜਿਹੜਾ ਆਪਣਾ ਪ੍ਰੋਜੈਕਟ ਨੂੰ ਪੂਰਾ ਕਰੀਏ ਅਤੇ ਕੋਈ ਵੀ ਜਿਹੜੀ ਹੈਗੀ ਆ ਅਣਬਣ ਜਿਹੜੀ ਹੈਗੀ ਸੀ ਸਾਡੇ ਵਿੱਚ ਉਹਨੂੰ ਭੁੱਲ ਜਾਈਏ ਤਾਂ ਕਿ ਉਸਦਾ ਜਿਹੜਾ ਅਸਰ ਹੈ ਸਾਡੇ ਪ੍ਰੋਜੈਕਟ 'ਤੇ ਨਾ ਪਏ ਅਤੇ ਇਹੀ ਜਿਹੜੀ ਹੈਗੀ ਆ ਮੇਰੀ ਮਤਲਬ ਕੰਮ ਸੀ ਜਦੋਂ ਮੈਨੂੰ ਕਿਸੇ ਨਾਲ਼ ਇੱਦਾਂ ਦੇ ਬੰਦੇ ਨਾਲ਼ ਜਾਂ ਫਿਰ ਇੱਦਾਂ ਦੀ ਕੁੜੀ ਨਾਲ਼ ਕੰਮ ਕਰਨਾ ਪਿਆ ਜਿਹਦੇ ਨਾਲ਼ ਮੇਰੀ ਮਿਲਣਾ ਬਹੁਤ ਹੀ ਮੁਸ਼ਕਿਲ ਸੀ ਬਟ ਉਹ ਵੀ ਜਿਹੜਾ ਹੈਗਾ ਸਮਾਂ ਮੈਂ ਬੜੀ ਸ ਚੰਗੀ ਤਰ੍ਹਾਂ ਸੁਲਝਾ ਲਿਆ ਸੀ ਅਤੇ ਉਹ ਹੋ ਵੀ ਗਿਆ ਸੀ ਅਤੇ ਸਾਡਾ ਜਿਹੜਾ ਪ੍ਰੋਜੈਕਟ ਆ ਉਹਨੂੰ ਫਸਟ ਪੁਜ਼ੀਸ਼ਨ ਵੀ ਮਿਲੀ ਸੀ